ਮੀਡੀਆ ਸਾਖਰਤਾ ਤੋਂ ਭਾਵ ਖ਼ਬਰਾਂ ਦਾ ਆਲੋਚਨਾਤਮਕ ਵਿਸ਼ੇਸ਼ਣ ਕਰਨਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹ ਨੂੰ ਵਧਾਉਣ ਕਿ ਉਹ ਕਿਸੇ ਤਰ੍ਹਾਂ ਦੇਸ਼ ਦੀਆਂ ਮੁਸ਼ਕਿਲਾਂ ਨੂੰ ਜਾਂ ਹਾਲਾਤਾਂ ਨੂੰ

ਜਿਨ੍ਹਾਂ ਵਿੱਚ ਵੱਖ ਵੱਖ ਮੀਡੀਆ ਅਧਿਕਾਰਾਂ ਆਪਣੇ ਭਾਸ਼ਣ ਜਾਂ ਜਾਣਕਾਰੀ ਨੂੰ ਸਾਂਝਾ ਕੀਤਾ ਜਾਂਦਾ ਹੈ ਉਹਨਾਂ ਨੂੰ ਸਾਰਾ ਸਮਝਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਇੱਕ ਖ਼ਬਰ ਦੀ ਤਹਿ ਤੱਕ ਪਹੁੰਚਣਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਐਡੂਸੈਂਟ ਸੋਸਾਇਟੀ ਦ ਪੰਜਾਬ ਆਈ ਸੀ ਟੀ ਐਜੂਕੇਸ਼ਨ ਸੁਸਾਇਟੀ ਅਤੇ ਦਸਵੰਤ ਨੈਟਵਰਕ ਅਜਿਹੇ ਪ੍ਰੋਗਰਾਮ ਡ ਡਿਜੀਟਲ ਸਾਖਰਤਾ ਨੂੰ ਵਧਾਉਣ ਲਈ ਸ਼ੁਰੂ ਕੀਤੇ ਗਏ